ਹਾਂਜੀ ਪੰਜਾਬ ਦੀ ਕਲਾ ਹੋ ਗਈ ਵੀ ਹੈ ਨਾ ਮਿੱਟੀ ਦੇ ਭਾਂਡੇ ਹੋ ਗਏ ਮਿੱਟੀ ਦਾ ਤਵਾ ਹੋ ਗਿਆ ਹੁਣ ਤਾਂ ਮਿੱਟੀ ਅਤੇ ਗਿੱਧਾ ਭੰਗੜਾ ਫੁਲਕਾਰੀ ਬਾਗ ਪਿੰਡ ਦਰੀਆਂ ਬਣਾਉਣਾ ਖੇਸ ਬਣਾਉਣੇ ਅਤੇ ਪੰਜਾਬੀ ਸੂਟ ਪਰਾਂਦੇ ਇਹ ਸਾਡਾ ਸਾਰੀ ਪੰਜਾਬ ਦੀ ਕਲਾ 'ਚ ਹੀ ਆ ਜਾਂਦਾ ਸਾਡਾ ਪੰਜਾਬੀ ਸੱਭਿਆਚਾਰ ਹੋ ਗਿਆ ਅਤੇ ਆਪਣਾ ਉਹ ਕੁਦਰਤੀ ਵਾਤਾਵਰਨ ਹੋ ਗਿਆ ਪਿੱਪਲ ਦੇ ਬੋਹੜ ਦੇ ਪੇੜ ਲਾਉਣੇ ਜਿਹਦੇ ਨਾਲ ਸਾਡਾ ਕੁਦਰਤੀ ਵਾਤਾਵਰਨ ਜਿਹੜਾ ਹੈਗਾ ਉਹ ਸ਼ੁੱਧ ਹੁੰਦਾ ਪੋਲਿਊਸ਼ਨ ਤੋਂ ਬਚਾਉਂਦੇ ਹੈ ਸਾਨੂੰ ਸਾਡੀ ਹਵਾ ਸ਼ੁੱਧ ਹੁੰਦੀ ਹੈ ਅਤੇ ਇਹ ਜਿਹੜਾ ਹੈ ਇਹ ਇਹ ਸਾਡਾ ਮੁਕਤਸਰ ਹੈ ਜਿਹੜਾ ਇਸ ਮੁਕਤਸਰ ਸਾਹਿਬ ਹੈ ਇਹ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਸਥਾਨ ਹੈ ਅਤੇ ਇੱਥੇ ਬਹੁਤ ਹੀ ਵੱਡੇ ਜਸ਼ਨ ਮਨਾਏ ਜਾਂਦੇ ਆ ਦਸਵੇਂ ਪਾਤਸ਼ਾਹ ਨੇ ਇੱਥੇ ਅਖੀਰਲੀ ਜੰਗ ਲੜੀ ਸੀਗੀ ਅਤੇ ਇਹ ਉਥੋਂ ਫਿਰ ਚਾਲੀ ਸਿੰਘਾਂ ਨੇ ਜਦੋਂ ਲੜਾਈ ਕੀਤੀ ਤਾਂ ਉਹ ਮੁਕਤੀ ਮੁਕਤੀਸਰ ਦਾ ਨਾਮ ਦਿੱਤਾ ਗਿਆ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਚਾਲੀ ਸਿੰਘਾਂ ਨੂੰ ਮੁਕਤੀ ਦਿੱਤੀ ਅਤੇ ਮੁਕਤੀ ਤੋਂ ਹੀ ਮੁਕਤਸਰ ਬਣਿਆ ਇਹ ਅਤੇ ਇਹ ਇੱਕ ਬਹੁਤ ਹੀ ਇਤਿਹਾਸਿਕ ਸਥਾਨ ਹੈ ਮੁਕਤਸਰ ਸਾਹਿਬ ਅਤੇ ਫਿਰ ਇਹਦਾ ਇਹ ਸਾਡੇ ਇੱਥੇ ਬਹੁਤ ਵੱਡਾ ਜਸ਼ਨ ਵਧੀਆ ਮਨਾਇਆ ਜਾਂਦਾ ਗੁਰਪੁਰਬ ਮਨਾਏ ਜਾਂਦੇ ਆ ਪਾਤਸ਼ਾਹ ਦੇ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਤੇਗ ਬਹਾਦਰ ਜੀ ਦਾ ਅਤੇ ਅਤੇ ਜਿਹੜੀ ਇਹ ਸਰਕਾਰ ਹੈਗੀ ਇਹ ਇਹਨਾਂ ਦੇ ਸਨਮਾਨ ਕੀਤੇ ਜਾਂਦੇ ਆ ਗੁਰਪੁਰਬ ਮਨਾ ਕੇ ਸਨਮਾਨ ਕੀਤੇ ਜਾਂਦੇ ਆ ਜਸ਼ਨ ਮਨਾਏ ਜਾਂਦੇ ਆ ਅਤੇ ਬਾਕੀ ਜਦੋਂ ਇੱਥੇ ਆਪਣਾ ਮੇਲੇ ਲੱਗਦੇ ਆ ਆਪਣਾ ਵਿਸਾਖੀ ਦਾ ਮੇਲਾ ਲੱਗਦਾ ਬੜਾ ਭਾਰੀ ਹੁੰਦਾ ਮਾਘੀ ਦਾ ਮੇਲਾ ਲੱਗਦਾ ਇੱਥੇ ਅਤੇ ਉਸ ਮੇਲੇ ਦੇ ਵਿੱਚ ਵੀ ਫਿਰ ਆਪਣਾ ਸ ਸਰਕਾਰ ਵੀ ਆਪੋ ਆਪਣਾ ਪ੍ਰਚਾਰ ਕਰਦੀ ਹੈ ਆਪੋ ਆਪਣੀਆਂ ਪਾਰਟੀਆਂ ਦਾ ਹੋ ਗਿਆ ਪ੍ਰਚਾਰ ਕਰਦੀ ਹੈ ਜਿਵੇਂ ਆਪਣਾ ਸ਼੍ਰੋਮਣੀ ਕਮੇਟੀ ਦਾ ਹੁੰਦਾ ਅਤੇ ਇੱਦਾਂ ਹੀ ਸਾਡੇ ਸਾਰੇ ਜਸ਼ਨ ਮਨਾਏ ਜਾਂਦੇ ਆ ਪੰਜਾਬ ਦੇ ਵਿੱਚ ਸਾਡੀ ਆਪਦੀ ਸੰਸਕ੍ਰਿਤੀ ਸਾਡੀ ਜਿਹੜੀ ਇਹ ਸਾਡੀ ਕਲਾ ਅਤੇ ਕੁਦਰਤੀ ਵਾਤਾਵਰਨ ਅਤੇ ਇੱਦਾਂ ਸਾਡੇ ਜਸ਼ਨ ਮਨਾਏ ਜਾਂਦੇ